ਹੈਲੋ ਹਾਂਜੀ ਸੱ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਬਸ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਅੱਛਾ ਮੈਮ ਮੈਂ ਨਾ ਐਡਵਾਈਸ ਲੈਣੀ ਸੀ ਤੁਹਾਡੇ ਤੋਂ ਮੈਂ ਆਪਣੇ ਬੇਟੇ ਨੂੰ ਨਾ ਸਕੂਲ ਪਾਉਣਾ ਹੈ ਅਤੇ ਮੈਨੂੰ ਸਮਝ ਨਹੀਂ ਆ ਹਾਂ ਨਿਊ ਅਡਮੀਸ਼ਨ ਕਰਾਉਣੀ ਹੈ ਅਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਤਰਨ ਤਾਰਨ ਦਾ ਕਿਹੜਾ ਸਕੂਲ ਜਿਹੜਾ ਬੈਟਰ ਹੈ ਜਿੱਥੇ ਬੱਚੇ ਦੀ ਕੇਅਰ ਬਹੁਤ ਹੋਵੇ ਕਿਉਂਕਿ ਜ਼ਿਆਦਾਤਰ ਹਾਂ ਜ਼ਿਆਦਾਤਰ ਸਕੂਲਾਂ ਦੇ ਵਿੱਚ ਸਟੱਡੀ ਦਾ ਬੋਝ ਹੈ ਅਤੇ ਬੱਚਿਆਂ ਦੀ ਇੰਨੀ ਕੇਅਰ ਨਹੀਂ ਹੈ ਅਤੇ ਬੱਚਿਆਂ ਦੀ ਕੇਅਰ ਨਹੀਂ ਹੈਗੀ ਅਤੇ ਮੈਂ ਕਿਹਾ ਮੈਂ ਸੋਚਿਆ ਚਲੋ ਤੁਹਾਡੇ ਕੋਲੋਂ ਸਲਾਹ ਲੈਂਦੀ ਹਾਂ ਕਿ ਕਿਹੜਾ ਸਕੂਲ ਜਿਹੜਾ ਬੈਟਰ

ਅੱਛਾ ਜੀ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਇੱਕ ਹਾਂਜੀ ਇੱਕ ਮੈਂ ਨਾ ਇੰਜਲ ਪੈਰਾਡਾਈਜ ਬਾਰੇ ਸੁਣਿਆ ਹੈ ਕਹਿੰ ਕਹਿੰਦੇ ਕਿ ਛੋਟੇ ਬੱਚੇ ਦੀ ਨਾ ਕੇਅਰ ਬਹੁਤ ਜ਼ਿਆਦਾ ਹੈ ਉੱਥੇ ਵੀ ਬੱਚੇ ਨੂੰ ਬਹੁਤ ਜ਼ਿਆਦਾ ਵਧੀਆ ਡੀਲ ਕਰਦੇ ਨੇ ਅਤੇ ਮੈਂ ਸੋਚ ਰਹੀ ਸੀ ਨਹੀਂ ਮੈਮ ਹੁਣ ਅੱਗੇ ਵਧਾ ਵਧਾ ਤਾ ਜੀ ਉਹਨਾਂ ਨੇ ਅੱਗੇ ਨਾ ਹਾਂਜੀ ਹਾਂਜੀ ਉਹ ਅੱਗੇ ਜੇ ਐੱਮ ਐੱਸ ਜੇ ਐੱਮ ਐੱਸ ਇੰਟਰਨੈਸ਼ਨਲ ਨਹੀਂ ਬਹੁਤ ਹੀ ਵਧੀਆ ਸਕੂਲ ਜੇ ਮੈਂ ਤਾਂ ਉਹਦੇ ਬਾਰੇ ਬਹੁਤ ਸੁਣਿਆ ਜੀ ਅਤੇ ਹਾਂ ਉਹਨੂੰ ਲੱਗਦਾ ਕਿ ਤਰਨ ਤਾਰਨ 'ਚ ਅਗਰ ਤੁਸੀਂ ਆਪਣੇ ਛੋਟੇ ਬੱਚਿਆਂ ਨੂੰ ਪਾਉਣਾ ਚਾਹੁੰਦੇ ਹੋ ਤਾਂ ਬੈਸਟ ਬੈਸਟ ਉਹ ਹੀ ਜੇ ਹਾਂ ਕਹਿੰਦੇ ਕਿ ਬਹੁਤ ਜ਼ਿਆਦਾ ਬੱਚਿਆਂ ਦੀ ਕੇਅਰ ਹੈ ਉੱਥੇ ਅਤੇ ਮੈਂ ਸੋਚ ਰਹੀ ਸੀ ਕਿ ਮੈਂ ਕਿਹਾ ਚਲੋ ਮੈਮ ਦੀ ਸਲਾਹ ਲੈਂਦੀ ਹਾਂ ਕਿ ਕਿਹੜਾ ਸਕੂਲ ਜ਼ਿਆਦਾ ਬੈਟਰ ਠੀਕ ਠੀਕ ਹੈ ਅਤੇ ਮੈਮ ਚਲੋ ਆਪਾਂ ਇਕੱਠੇ ਹੀ ਚਲੇ ਚੱਲਾਂਗੇ ਹੈਂ ਠੀ ਠੀਕ ਹੈ ਠੀਕ ਹੈ ਮੈਮ ਚਲੋ ਠੀਕ ਹੈ ਮੈਮ ਹਾਂ ਠੀਕ ਹੈ ਜੀ ਸ